ਹੈਲੋ ਹਾਂਜੀ ਹਾਂਜੀ ਸਰ ਬੋਲੋ ਜੀ ਓਕੇ ਓਕੇ ਮਤਲਬ ਤੁਸੀ ਸਟੂਡੈਂਟ ਹੋ ਅਗਰ ਤੂੰ ਮੈਨੂੰ ਦੱਸੋਂਗੇ ਤੁਸੀ ਪਲੱਸ ਟੂ ਕਿਹੜੇ ਸਾਲ 'ਚ ਪਾਸ ਕੀਤੀ ਹੈ ਦੋ ਹਜ਼ਾਰ ਇੱਕੀ ਤੁਹਾਡੀ ਪਲੱਸ ਟੂ ਹੋਈ ਹੈ ਅਤੇ ਤੁਹਾਡੇ ਕੋਲ ਡਿਪਲੋਮਾ ਕਿਸ ਸਟੇਟ ਦਾ ਹੈ ਮਕੈਨੀਕਲ ਹੈ ਕਿਵੇਂ ਡਿਪਲੋਮਾ ਇੱਕ ਤਾਂ ਮੈਂ ਕੰਪਿਊਟਰ ਡਿਪਲੋਮਾ ਅਤੇ ਰੀਸੈਂਟ ਤੁਸੀ ਕੋਈ ਜੋਬ ਕਰ ਰਹੇ ਹੋ ਤੁਸੀ ਫ੍ਰੀ ਹੋ ਤੁਹਾਡਾ ਐਡਰੈੱਸ ਕੀ ਹੈ ਜੀ ਬਸੀ ਪਠਾਣਾਂ ਵੈਸੇ ਵੀ ਤੁਹਾਡਾ ਜਿਹੜਾ ਜ਼ਿਲ੍ਹਾ ਹੈ ਫਤਿਹਗੜ੍ਹ ਜ਼ਿਲ੍ਹਾ ਹੈ ਅਤੇ ਬ੍ਰਦਰ ਇਸ ਤਰ੍ਹਾਂ ਹੈ ਤੁਹਾਡੀ ਜਿਹੜੀ ਪਲਸ ਟੂ ਜਿਹੜੀ ਜੋਬ ਹੈਗੀ ਹੈ ਇਸ ਬੇਸ 'ਤੇ ਜਿਹੜੀ ਗਵਰਮੈਂਟ ਜੋਬ ਜੋਬ ਦੇ ਵਿੱਚ ਸਕੋਪ ਤਾਂ ਤੁਹਾਡਾ ਕਾਫੀ ਜ਼ਿਆਦਾ ਘੱਟ ਹੈ ਕਿਉਂਕਿ ਗਵਰਮੈਂਟ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਕਾਫੀ ਹਾਇਰ ਹੋ ਚੁੱਕੀਆਂ ਨੇ ਤੁਹਾਨੂੰ ਇਹਦੇ ਬਾਰੇ ਪਤਾ ਹੀ ਹੋਏਗਾ ਤੁਸੀਂ ਕੋਈ ਇਸ ਤੋਂ ਇਲਾਵਾ ਕੋਈ ਸਕਿੱਲ ਕੋਈ ਮਤਲਬ ਰੱਖਦੇ ਹੋ ਯੋਗਤਾ ਕੋਈ ਕੋਈ ਪ੍ਰਾਈਵੇਟ ਕੰਮ ਜਿਵੇਂ ਤੁਸੀ ਪਹਿਲਾਂ ਕੀਤਾ ਹੋਵੇ ਕਿਸੇ ਮਕੈਨਿਕਲ ਫੀਲਡ 'ਚ ਜਾਂ ਕਿਸੇ ਕੰਪਿਊਟਰ ਤੁਸੀਂ ਡਾਟਾ ਐਂਟਰੀ ਦਾ ਕੰਮ ਕਰ ਲੈਂਦੇ ਹੋ ਕੰਪਿਊਟਰ ਜਿਹੜਾ ਡਾਟਾ ਜਿਵੇਂ ਫੀਡ ਹੁੰਦਾ ਹੈ ਦੇਖੋ ਸਾਡੇ ਕੋਲੇ ਏਦਾਂ ਹੈਗਾ ਸਾਡੇ ਕੋਲੇ ਪ੍ਰਾਈਵੇਟ ਸੈਕਟਰ ਦੇ ਵਿੱਚ ਕਾਫੀ ਸਾਰੀਆਂ ਇੰਡਸਟਰੀਆਂ ਨੇ ਜਿਹਨਾਂ ਨੂੰ ਡਾਟਾ ਐਂਟਰੀ ਓਪਰੇਟਰਾਂ ਦੀ ਲੋੜ ਹੈਗੀ ਹੈ ਅਗਰ ਤਾਂ ਤੁਸੀਂ ਨਹੀਂ ਉਹ ਫੁੱਲ ਡੇਅ ਹੀ ਤੁਹਾਨੂੰ ਮਿਲੇਗੀ ਫਿਲਹਾਲ ਜਿਹੜੀ ਤੁਹਾਨੂੰ ਹੈਗੀ ਆ ਪਹਿਲਾਂ ਪਾਰਟ ਟੈਮ ਦੀ ਹੋਏਗੀ ਜੋ ਕਿ ਤਿੰਨ ਚਾਰ ਮਹੀਨੇ ਵਾਸਤੇ ਟ੍ਰੈਲ ਬੇਸ 'ਤੇ ਹੋਏਗੀ ਉਸ ਤੋਂ ਬਾਅਦ ਤੁਹਾਨੂੰ ਫੁੱਲ ਜੇ ਫੁੱਲ ਜੋਬ ਫੁੱਲ ਟੈਮ ਜੋਬ ਕੰਪਨੀ ਔਫਰ ਕਰੇਗੀ ਕੀ ਤੁਸੀ ਪ੍ਰਾਈਵੇਟ ਸੈਕਟਰ 'ਚ ਤੁਸੀਂ ਪ੍ਰਾਈਵੇਟ ਸੈਕਟਰ 'ਚ ਜੋਬ ਲੈਣਾ ਚਾਹੁੰਦੇ ਹੋ ਜਾਂ ਗਰਵਮੈਂਟ ਸੈਕਟਰ 'ਚ ਦੇਖੋ ਤੁਸੀਂ ਪੇਅ ਜਿਹੜੀ ਹੈਗੀ ਆ ਤੁਸੀ ਕਿੰਨੀ ਕ ਪੇਅ ਲੈਣਾ ਚਾਹੁੰਦੇ ਹੋ ਮਤਲਬ ਥੋਨੂੰ ਪਤਾ ਉਮੀਦ ਹੋਵੇ ਵੀ ਕਿੰਨੀ ਕੁ ਹੋਵੇ ਚਲੋ ਇਸ ਤਰਾਂ ਹੈਗਾ ਤੁਸੀ ਸਾਡੇ ਨਾ ਐਡਰੈੱਸ 'ਤੇ ਆਪਣਾ ਜਿਹੜਾ ਪ੍ਰੋਫਾਈਲ ਹੈਗਾ ਆਪਣੀ ਕੁਆਲੀਫੀਕੇਸ਼ਨ ਜੋ ਡਿਗਰੀਸ ਵਗੈਰਾ ਹੈਗੀ ਜਿੰਨੀ ਵੀ ਤੁਹਾਡੇ ਕੋਲ ਕੁਆਲੀਫੀਕੇਸ਼ਨ ਹੈ ਉਹ ਮੈਨੂੰ ਤੁਸੀਂ ਭੇਜ ਦਿਓ ਅਸੀਂ ਤੁਹਾਡੀ ਯੋਗਤਾ ਮੁਤਾਬਕ ਅਸੀਂ ਕਈ ਕੰਪਨੀਆਂ 'ਚ ਤੁਹਾਡਾ ਜਿਹੜਾ ਰਿਜ਼ਿਊਮ ਹੈਗਾ ਅਸੀਂ ਰੈਕਮੈਂਡ ਕਰ ਦਵਾਂਗੇ ਤੁਹਾਨੂੰ ਜਲਦੀ ਕੋਈ ਨਾ ਕੋਈ ਨੌਕਰੀ ਤੁਹਾਨੂੰ ਜਲਦੀ ਕੋਈ ਨਾ ਕੋਈ ਨੌਕਰੀ ਕੋਈ ਨਾ ਤੁਸੀਂ ਮੈਨੂੰ ਵਟਸਐਪ ਰਾਹੀਂ ਭੇਜਦੋ ਅਸੀਂ ਜਲਦੀ ਤੁਹਾਡਾ ਰਿਜ਼ਿਊਮ ਕਈ ਕੰਪਨੀਆਂ ਨੂੰ ਭੇਜ ਦੇਵਾਂਗੇ ਆਈ ਹੋਪ ਤੁਹਾਨੂੰ ਜਲਦੀ ਹੀ ਨੌਕਰੀ ਮਿਲ ਜਾਏਗੀ ਕੋਈ ਨਾ ਕੋਈ ਠੀਕ ਆ ਜੀ ਕੋਈ ਨਹੀਂ ਬ੍ਰਦਰ ਅਸੀਂ ਅਸੀਂ ਦੋਨੋਂ ਪਾਸੇ ਟਰਾਈ ਕਰਦੇ ਹਾਂ ਤੁਹਾਡਾ ਦੋਨੋਂ ਪਾਸੇ ਹੋ ਜਾਵੇ ਤਾਂ ਵਧੀਆ ਗੱਲ ਹੈ ਠੀਕ ਹੈ ਨਾ ਜੀ ਚਲੋ ਠੀਕ ਹੈ ਸਰ ਓਕੇ ਜੀ ਓਕੇ ਜੀ ਓਕੇ